ਸਤਿ ਸ਼੍ਰੀ ਅਕਾਲ ਮੈਂ ਅੱਜ ਤੋਂ ਥੋੜ੍ਹੇ ਦਿਨ ਪਹਿਲਾਂ ਤੁਹਾਡੀ ਕੰਪਨੀ ਤੋਂ ਇੱਕ ਪੱਖਾ ਮੰਗਵਾਇਆ ਸੀ ਜੋ ਕਿ ਹੈਵਿਲ ਕੰਪਨੀ ਦਾ ਸੀ ਇਹ ਪੱਕਾ ਬਹੁਤ ਹੀ ਸ਼ਾਨਦਾਰ ਹੈ ਇਸ ਦੀ ਹਵਾ ਬਹੁਤ ਹੀ ਸ਼ਾਨਦਾਰ ਹੈ ਇਸਦਾ ਰੰਗ ਵੀ ਬਹੁਤ ਵਧੀਆ ਹੈ ਜਿਸ ਤਰ੍ਹਾਂ ਅਸੀਂ ਆਨਲਾਈਨ ਇਹ ਪੱਖਾ ਮੰਗਵਾਇਆ ਸੀ ਉਸ ਪਿਚਰ ਵਿੱਚ ਦੇਖਿਆ ਸੀ ਇਹ ਪੂਰੀ ਤਰ੍ਹਾਂ ਉਸੇ ਤਰ੍ਹਾਂ ਹੀ ਹੈ ਬਿਲਕੁਲ ਚੇਂਜਸ ਨਹੀਂ ਹੈ ਇਸ ਦੀ ਹਵਾ ਬਹੁਤ ਹੀ ਸ਼ਾਨਦਾਰ ਹੈ ਇਸਦੀ ਮੋਟਰ ਜਿਹਦੀ ਕੁਆਲਿਟੀ ਬਹੁਤ ਵਧੀਆ ਹੈ ਇਹ ਬਿਲਕੁਲ ਵੀ ਹਿਟ ਨਹੀਂ ਮਾਰਦੀ ਇਹ ਪੱਖਾ ਇਕੁਅਲੀ ਹਵਾ ਦਿੰਦਾ ਹੈ ਅਤੇ ਇਹ ਪੱਖੇ ਦੀ 'ਤੇ ਡਸਟ ਜਿਹੜੀ ਉਹ ਬਿਲਕੁਲ ਵੀ ਪੈਦਾ ਨਹੀਂ ਹੁੰਦੀ ਡਸਟ ਬਹੁਤ ਹੀ ਜ਼ਿਆਦਾ ਘੱਟ ਹੁੰਦੀ ਹੈ ਸ਼ਾਨਦਾਰ ਪੱਖਾ ਆ ਉਹ ਗਰੰਟੀ ਵੀ ਇਹਦੀ ਦਿੱਤੀ ਆ ਅਤੇ ਇਹ ਪੱਖੇ ਦੀ ਬਿਲਕੁਲ ਵੀ ਖ਼ਰਾਬੀ ਜਿਹੜੀ ਆ ਉਹ ਨਜ਼ਰ ਨਹੀਂ ਆਉਂਦੀ ਇਸ ਕਾਰਨ ਇਹ ਸਾਨੂੰ ਬਹੁਤ ਹੀ ਵਧੀਆ ਲੱਗਿਆ ਔਰ ਹਾਂ ਇਹ ਇਸੇ ਡਿਲੀਵਰੀ ਜਦੋਂ ਆਪਾਂ ਡਿਲੀਵਰੀ ਕੀਤੀ ਸੀ ਉਸੇ ਟਾਈਮ 'ਤੇ ਕਰੰਟ ਲੋਕੇਸ਼ਨ 'ਤੇ ਇਹ ਆ ਗਿਆ ਸੀ ਇਸ ਦੀ ਕੰਪਨੀ ਜਿਹੜੀ ਆ ਉਹ ਬਹੁਤ ਹੀ ਵਧੀਆ ਹੈ ਅਸੀਂ ਇਸ ਕੰਪਨੀ ਦੇ ਹੋਰ ਵੀ ਪੱਖੇ ਮੰਗਵਾਏ ਹਨ ਇਸ ਕਾਰਨ ਕਿਉਂਕਿ ਇਹ ਬਹੁਤ ਹੀ ਵਧੀਆ ਹੈ ਅਸੀਂ ਹਾਂ ਅਸੀਂ ਚਾਵਾਂਗੇ ਕਿ ਅਸੀਂ ਹੋਰ ਵੀ ਇਸ ਕੰਪਨੀ ਦੀ ਜਿਹੜੇ ਆ ਪੱਖੇ ਜਿਹੜੇ ਆ ਹੋਰ ਵੀ ਚੀਜ਼ਾਂ ਜਿਹੜੀਆਂ ਇਸ ਕੰਪਨੀ ਦੇ ਥਰੂ ਹੀ ਲੈ ਕੇ ਆਵਾਂਗੇ ਅਤੇ ਇਹ ਸਾਨੂੰ ਇਹ ਪ੍ਰੋਡਕਟ ਤੁਹਾਡਾ ਬਹੁਤ ਹੀ ਜ਼ਿਆਦਾ ਵਧੀਆ ਲੱਗਿਆ ਕਿਉਂਕਿ ਇਹ ਬਹੁਤ ਹੀ ਸ਼ਾਨਦਾਰ ਪ੍ਰੋਡਕਟ ਸੀ ਕਿਉਂਕਿ ਇਸਦੀ ਹਵਾ ਜਿਹੜੀ ਆ ਉਹ ਬਹੁਤ ਸ਼ਾਨਦਾਰ ਹੈ ਹੀਟ ਬਿਲਕੁਲ ਨਹੀਂ ਮਾਰਦੀ ਜਿਹੜੀ ਇਸ ਪੱਖੇ ਵਿੱਚ ਲਾਈਟਾਂ ਜਗਦੀਆਂ ਉਹ ਬਿਲਕੁਲ ਹੀ ਸਹੀ ਜਗਦੀਆਂ ਹਨ ਇਹਨਾਂ ਵਿੱਚ ਕੋਈ ਬੀ ਖ਼ਰਾਬ ਨਹੀਂ ਹੈ ਇਸ ਕਾਰਨ ਸਾਨੂੰ ਪ੍ਰੋਡਕਟ ਬਹੁਤ ਹੀ ਵਧੀਆ ਲੱਗਿਆ ਥੈਂਕ ਯੂ